ਜੇ ਫਸਲਾਂ ਸੰਬੰਧੀ ਕੀੜੇ ਮਕੌੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਮਿੱਤਰ ਕੀੜੇ ਨੂੰ ਸੰਭਾਲ ਕਰਨੀ ਚਾਹੀਦੀ ਹੈ ਪਰਾਲੀ ਨੂੰ ਅੱਗ ਵਗੈਰਾ ਨਾ ਲਾਈਏ ਅਤੇ ਸਮੇਂ ਸਿਰ ਜ਼ਮੀਨ ਦੀ ਬਿਜਾਈ ਭਾਈ ਪਾਣੀ ਲਾਈਏ ਰੇਹ ਅਤੇ ਸਪਰੇ ਤੋਂ ਸੰਕੋਚ ਕਰੀਏ ਘੱਟ ਪਾਈਏ ਅਤੇ ਵੱਧ ਤੋਂ ਵੱਧ ਰੂੜੀ ਦੀ ਖਾਦ ਖਾਦ ਸਾਨੂੰ ਪਾਉਣੀ ਚਾਹੀਦੀ ਹੈ ਅਤੇ ਸਮੇਂ ਸਮੇਂ 'ਤੇ ਗੋਡੀ ਵਗੈਰਾ ਕਰਨੀ ਚਾਹੀਦੀ ਇਸ ਕਰਕੇ ਅਸੀਂ ਮਿੱਤਰ ਕੀੜੇ ਬਚਾਅ ਸਕਦੇ ਹਾਂ ਧੰਨਵਾਦ